ਸਰ ਮੈਂ ਹੁਣੇ ਤੁਹਾਡੇ ਰੈਸਟੋਰੈਂਟ ਤੋਂ ਇੱਕ ਕੇਕ ਔਡਰ ਕੀਤਾ ਹੈ ਮੈਂ ਬਸ ਇੱਕ ਦੋ ਚੀਜ਼ਾਂ ਪੁੱਛਣੀਆਂ ਸੀ ਇੱਕ ਕੀ ਉਹ ਕੇਕ ਬਿਨਾਂ ਆਂਡੇ ਤੋਂ ਵੀ ਅਵੇਲੇਬਲ ਹੈ ਕਿਉਂਕਿ ਔਨਲਾਈਨ ਉਹ ਕੁਛ ਮੈਨਸ਼ਨ ਨਹੀਂ ਹੈ ਕਿ ਉਹ ਐਗਲਸ ਹੈ ਜਾਂ ਵਿੱਦ ਐਗ ਹੈ ਦੂਸਰਾ ਚੀਜ਼ ਉਹਦੇ ਉੱਤੇ ਇੱਕ ਮੈਸੇਜ ਲਿਖਾਉਣਾ ਹੈ ਜੋ ਮੈਨੂੰ ਉਦਾਂ ਅੋਪਸ਼ਨ ਮਿਲ ਨਹੀਂ ਰਹੀ ਅਤੇ ਮੈਂ ਫੋਨ 'ਤੇ ਦੱਸਣਾ ਚਾਹ ਰਿਹਾਂ ਕਿ ਉਹਦੇ ਉੱਤੇ ਹੈਪੀ ਬਰਡੇ ਮਹਿਕ ਲਿਖਣਾ ਹੈ